ਮੈਂ ਇੱਕ ਵਾਰ ਆਪਣੇ ਕੋਲਜ ਦੇ ਇੱਕ ਡਰਾਇੰਗ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਮੈਂ ਮਾਂ ਅਤੇ ਬੱਚੇ ਦੇ ਪਿਆਰ ਨੂੰ ਦਰਸਾਇਆ ਇਹ ਦ ਪਿਚਰ ਇੰਨੀ ਜ਼ਿਆਦਾ ਸੋਹਣੀ ਬਣੀ ਕਿ ਮੈਂ ਉਸ ਮੁਕਾਬਲੇ ਵਿੱਚ ਪਹਿਲੇ ਨੰਬਰ 'ਤੇ ਆਈ ਸਾਰਿਆਂ ਨੇ ਇਹ ਮੇਰੇ ਦੁਆਰਾ ਬਣਾਈ ਇਸ ਡਰਾਇੰਗ ਦੀ ਖੂਬ ਪ੍ਰਸ਼ੰਸਾ ਕੀਤੀ ਸਾਰੇ ਉਸ ਨੂੰ ਵਾਰ ਵਾਰ ਦੇਖ ਰਹੇ ਸਨ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਕਿਉਂਕਿ ਸਾਰੇ ਲੋਕ ਮੇਰੇ ਵੱਲੋਂ ਬਣਾਈ ਡਰਾਇੰਗ ਦੀਆਂ ਤਰੀਫਾਂ ਕਰ ਰਹੇ ਸਨ ਮੇਰੇ ਵੱਲੋਂ ਬਣਾਈ ਰਚਨਾ ਵਿੱਚ ਫੀਡਬੈਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਫੀਡਬੈਕ ਰਾਹੀਂ ਸਾਨੂੰ ਗਲਤ ਅਤੇ ਸਹੀ ਦਾ ਪਤਾ ਲੱਗਦਾ ਹੈ ਮੈਂ ਆਪਣੀ ਡਰਾਇੰਗ ਪ੍ਰਕਿਰਿਆ ਵਿੱਚ ਫੀਡਬੈਕ ਚਾਹੁੰਦੀ ਹਾਂ ਕਿ ਜੇਕਰ ਰਚਨਾ ਸਹੀ ਹੈ ਤਾਂ ਸਹੀ ਕਹੀ ਜਾਵੇ ਜੇਕਰ ਕੋਈ ਚੀਜ਼ ਗਲਤ ਹੈ ਤਾਂ ਉਸ ਦੀ ਆਲੋਚਨਾ ਵੀ ਕੀਤੀ ਜਾਵੇ ਫੀਡਬੈਕ ਵੱਡਾ ਰੋਲ ਅਦਾ ਕਰਦੀ ਹੈ ਕਿਸੇ ਵੀ ਰਚਨਾ ਦੇ ਲਈ